ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਹੈ ਮੈਂ ਟੀ ਵੀ ਤੋਂ ਜਾਂ ਕਿਸੇ ਵੀ ਚੈਨਲ 'ਤੇ ਖਾਣਾ ਬਣਾਉਣ ਦੀਆਂ ਰੈਸਪੀਆਂ ਦੇਖਦੀ ਰਹਿੰਦੀ ਹਾਂ ਮੈਂ ਯੂਟਿਊਬ ਤੋਂ ਮੈਗੀ ਦੀ ਰੈਸਪੀ ਦੇਖੀ ਸੀ ਅਤੇ ਮੈਂ ਪਹਿਲਾਂ ਆਪੇ ਦੋ ਪਿਆਜ਼ ਕੱਟੇ ਇੱਕ ਟਮਾਟਰ ਕੱਟਿਆ ਅਤੇ ਫਿਰ ਮਟਰ ਕੱਢੇ ਅਤੇ ਫਿਰ ਗੈਸ ਨੂੰ ਬਾਲਿਆ ਅਤੇ ਫਿਰ ਉਸਦੇ ਵਿੱਚ ਤੇਲ ਪਾਇਆ ਜਦੋਂ ਤੇਲ ਗਰਮ ਹੋ ਗਿਆ ਤਾਂ ਮੈਂ ਉਸ ਵਿੱਚ ਪਿਆਜ਼ ਪਾ ਦਿੱਤੇ ਫਿਰ ਮੈਂ ਉਸ ਵਿੱਚ ਜੀਰਾ ਪਾ ਦਿੱਤਾ ਫਿਰ ਮੈਂ ਟਮਾਟਰ ਪਾ ਦਿੱਤੇ ਜਦੋਂ ਇਹ ਸਾਰਾ ਕੁਛ ਚੰਗੀ ਤਰ੍ਹਾਂ ਬਣ ਗਿਆ ਤਾਂ ਫਿਰ ਮੈਂ ਉਸ ਵਿੱਚ ਗਰਮ ਪਾ ਉਸ ਵਿੱਚ ਮੈਂ ਪਾਣੀ ਪਾ ਦਿੱਤਾ ਅਤੇ ਪਾਣੀ ਰਿੱਝਣ ਦੇ ਉਸ ਵਿੱਚ ਮੈਂ ਮੈਗੀ ਪਾ ਦਿੱਤੀ ਅਤੇ ਥੋੜ੍ਹੇ ਟਾਈਮ ਤੱਕ ਮੈਂ ਉਸਨੂੰ ਢੱਕਣ ਦੇ ਕੇ ਬੰਦ ਕਰ ਦਿੱਤਾ ਅਤੇ ਥੋੜ੍ਹੇ ਟਾਈਮ ਤੱਕ ਮੇਰੀ ਮੈਗੀ ਬਣ ਗਈ ਸੀ